ਹੈਲੋ ਅਨਮੋਲ ਇਲੈਕਟ੍ਰੋਨਿਕਸ ਮੈਂ ਪਿਛਲੇ ਹਫਤੇ ਤੁਹਾਡੀ ਦੁਕਾਨ ਤੋਂ ਇੱਕ ਸੈਮਸੰਗ ਦਾ ਫੋਨ ਖਰੀਦਿਆ ਸੀ ਜਿਸ ਤੋਂ ਮੈਨੂੰ ਬਹੁਤ ਜ਼ਿਆਦਾ ਆਸ ਸੀ ਪਰ ਇਸ ਵਿੱਚ ਬਹੁਤ ਜ਼ਿਆਦਾ ਰੈਮ ਹੋਣ ਤੋਂ ਬਾਵਜੂਦ ਵੀ ਇਹ ਫੋਨ ਬਹੁਤ ਜ਼ਿਆਦਾ ਹੈਂਗ ਕਰਦਾ ਹੈ ਜਿਸ ਕਾਰਨ ਮੈਨੂੰ ਆਪਣੀ ਐਪ ਯੂਜ਼ ਵਿੱਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਅਤੇ ਇਸ ਫੋਨ ਦੀ ਕੈਮਰਾ ਕੁਆਲਿਟੀ ਵੀ ਕੋਈ ਬਹੁਤ ਜ਼ਿਆਦਾ ਅੱਛੀ ਨਹੀਂ ਹੈ ਜਿਸ ਕਾਰਨ ਮੈਨੂੰ ਆਪਣੀ ਸੈਲਫੀ ਅਤੇ ਹੋਰ ਡੋਕੂਮੈਂਟਾਂ ਦੀਆਂ ਫੋ ਫੋਟੋਆਂ ਲੈਣ ਵਿੱਚ ਵੀ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ